ਸਾਡੇ ਭਾਰਤ ਦੇ ਵਿੱਚ ਕਈ ਗੇਮਾਂ ਹਨ ਬਹੁਤ ਸਾਰੀ ਗੇਮਾਂ ਹਨ ਪਰ ਮੈਨੂੰ ਜਿਹੜੀ ਸਭ ਤੋਂ ਜ਼ਿਆਦਾ ਪਸੰਦ ਹੈ ਉਹ ਮੈਨੂੰ ਫਰੀ ਫਾਇਰ ਹੈ ਫਰੀ ਫਾਇਰ ਦੇ ਵਿੱਚ ਮਤਲਬ ਇੱਦਾਂ ਦੀ ਗੇਮ ਹੈ ਇਹ ਜਿਹਦੇ ਵਿੱਚ ਮਤਲਬ ਪੰਜਾਹ ਬੰਦੇ ਹੁੰਦੇ ਹਨ ਅਤੇ ਸਾਡੇ ਇੱਕ ਆਪਣੀ ਸਕੋਡ ਹੁੰਦੀ ਹੈ ਅਤੇ ਇੱਕ ਮੈਪ ਹੁੰਦਾ ਏ ਮੈਪ ਦੇ ਵਿੱਚ ਅਲੱਗ ਅਲੱਗ ਥਾਵਾਂ ਹੁੰਦੀਆਂ ਹਨ ਅਤੇ ਮਤਲਬ ਅਸੀਂ ਮਤਲਬ ਜਿਹੜੇ ਪੰਜਾਹ ਬੰਦੇ ਹੁੰਦੇ ਆ ਉਹ ਸਾਰੇ ਇੱਕ ਐਰੋਪਲੇਨ 'ਤੇ ਹੀ ਸਾਰੇ ਇਕੱਠੇ ਕੁੱਦ ਦੇ ਹਨ ਅਤੇ ਫਿਰ ਉਸ ਤੋਂ ਬਾਅਦ ਮਤਲਬ ਉੱਤਰ ਤੋਂ ਉਤਰਨ ਤੋਂ ਬਾਅਦ ਲੋਕ ਅਲੱਗ ਅਲੱਗ ਘਰਾਂ ਦੇ ਵਿੱਚ ਜਾ ਕੇ ਆਪਣਾ ਸਮਾਨ ਮਤਲਬ ਗੇਮ ਜਿੱਤਣ ਲਈ ਸਮਾਨ ਲੁੱਟਦੇ ਹਨ ਗੰਨਾਂ ਲੁੱਟਦੇ ਹਨ ਉਹਨਾਂ ਦੀ ਗੋਲੀਆਂ ਲੁੱਟਦੇ ਹਨ ਵੈੱਸਟ ਹੈੱਲਮਟ ਜੋ ਵੀ ਹੁੰਦਾ ਸਾਰਾ ਕੁਝ ਲੁੱਟਦੇ ਹਨ ਅਤੇ ਦੂਜੇ ਬੰਦਿਆਂ ਨੂੰ ਮਤਲਬ ਜੇਕਰ ਕੋਈ ਦੂਜਾ ਬੰਦਾ ਦਿਖਦਾ ਹੈ ਤਾਂ ਉਹਦੇ ਉੱਪਰ ਫਾਇਰਿੰਗ ਕਰਦੇ ਹਨ ਅਤੇ ਉਹ ਜੇਕਰ ਉਹ ਕਿੱਲ ਹੋਵੇ ਤਾਂ ਉਹਦਾ ਸਮਾਨ ਲੁੱਟ ਕੇ ਆਪਣੇ ਆਪਣੇ ਮਤਲਬ ਸਕੋਡ ਵਾਸਤੇ ਮਤਲਬ ਜਿੱਤ ਪ੍ਰਾਪਤ ਕਰਨ ਵਾਸਤੇ ਹੋਰ ਅੱਗੇ ਅੱਗੇ ਵੱਧਦੇ ਹਨ ਅਤੇ ਉਸ ਤੋਂ ਬਾਅਦ ਮਤਲਬ ਜਿੱਦਾਂ ਕਿ ਡਰੋਪ ਹੁੰਦਾ ਹੈ ਡਰੋਪ ਦੇ ਵਿੱਚ ਵਧੀਆ ਵਧੀਆ ਗੰਨਾਂ ਵੈੱਸਟ ਸਭ ਕੁਝ ਮਿਲਦਾ ਹੁੰਦਾ ਏ ਅਤੇ ਮਤਲਬ ਜਿੱਦਾਂ ਮਤਲਬ ਜਿੱਦਾਂ ਕਿ ਜ਼ੋਨ ਛੋਟਾ ਰਹਿੰਦਾ ਹੈ ਤਾਂ ਲੋਕ ਲੁੱਕ ਲੁੱਕ ਕੇ ਖੇਡਣ ਲੱਗ ਪੈਂਦੇ ਹਨ ਕਿਉਂਕਿ ਉਹ ਮਤਲਬ ਆਪਣੀ ਗੇਮ ਜਿੱਤਣ ਵਾਸਤੇ ਇੱਦਾਂ ਲੁੱਕ ਲੁੱਕ ਕੇ ਖੇਡਣਾ ਵੀ ਪਸੰਦ ਕਰਦੇ ਹਨ ਅਤੇ ਕਈ ਲੋਕ ਹੁੰਦੇ ਸਿੱਧਾ ਰਸ਼ ਕਰਦੇ ਆ ਜੀ ਅਤੇ ਮਤਲਬ ਰਸ਼ ਕਰਦੇ ਆ ਤਾਂ ਮਤਲਬ ਸਾਹਮਣੇ ਜਾ ਕੇ ਫਾਈਟ ਕਰਨ ਲੱਗ ਪੈਂਦੇ ਆ ਅਤੇ ਕਈ ਜਾਣੇ ਹੁੰਦੇ ਲੁੱਕ ਕੇ ਖੇਲਣਾ ਪਸੰਦ ਕਰਦੇ ਹਨ ਅਤੇ ਫਿਰ ਉਸ ਤੋਂ ਬਾਅਦ ਮਤਲਬ ਕਈ ਲੋਕ ਹੁੰਦੇ ਹਨ ਕਿ ਮਤਲਬ ਮਤਲਬ ਗਿਲੀ ਸੂਟ ਪਾ ਕੇ ਮਤਲਬ ਮਤਲਬ ਘਾਹ ਦੇ ਵਿੱਚ ਲੁੱਕ ਜਾਂਦੇ ਹਨ ਅਤੇ ਸਰਵਾਈਵ ਕਰਦੇ ਹਨ ਅਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਜਦ ਜ਼ੋਨ ਛੋਟਾ ਰਹਿ ਜਾਂਦਾ ਹੈ ਤਾਂ ਫਿਰ ਮਤਲਬ ਬੰਦੇ ਵੀ ਜ਼ਿਆਦਾ ਰਹਿੰਦੇ ਕਈ ਵਾਰੀ ਅਤੇ ਕਈ ਵਾਰੀ ਘੱਟ ਰਹਿ ਜਾਂਦੇ ਏ ਜੀ ਅਤੇ ਫਿਰ ਮਤਲਬ ਜੇਕਰ ਜ਼ਿਆਦਾ ਬੰਦੇ ਹੁੰਦੇ ਆ ਫਿਰ ਤਾਂ ਬੰਦੇ ਛੇਤੀ ਛੇਤੀ ਮੁੱਕ ਜਾਂਦੇ ਹਨ ਅਤੇ ਜੇਕਰ ਬੰਦੇ ਘੱਟ ਹੋਵੇ ਅਤੇ ਜ਼ੋਨ ਛੋਟਾ ਹੋਵੇ ਫਿਰ ਬੰਦੇ ਲੁੱਕਣਾ ਲਾਕਣਾ ਪਸੰਦ ਕਰਦੇ ਹਨ ਕਿਉਂਕਿ ਉਹ ਆਪਣੇ ਗੇਮ ਜਿੱਤਣ ਵਾਸਤੇ ਇੱਦਾਂ ਕਰਦੇ ਹਨ ਅਤੇ ਜਦੋਂ ਉਹਨਾਂ ਦਾ ਮਤਲਬ ਬੋਈਆ ਹੋ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਮਤਲਬ ਉਹ ਮਤਲਬ ਲੈਵਲ ਅੱਪ ਕਰਨ ਵਾਸਤੇ ਬੋਈਆ ਕਰਦੇ ਹਨ ਅਤੇ ਬੋਈਆ ਕਰਨ 'ਤੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਹਨ ਗੇਮ ਦੇ ਰਿਲੇਟਿਡ ਅਤੇ ਮਤਲਬ ਉਹਨਾਂ ਦੀ ਮਤਲਬ ਹੋਰ ਪਹਿਚਾਣ ਵਧੀਆ ਬਣ ਜਾਂਦੀ ਹੈ ਵਧੀਆ ਚੀਜ਼ਾਂ ਮਿਲਦੀਆਂ ਹਨ ਉਹਨਾਂ ਨੂੰ ਗੇਮ ਜਿੱਤਣ ਤੋਂ ਬਾਅਦ ਅਤੇ ਉਹਨਾਂ ਦੀ ਛੇਤੀ ਛੇਤੀ ਆਈ ਡੀ ਮਤਲਬ ਇੰਪਰੂਵ ਕਰਦੀ ਹੈ ਜੀ